ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਤੁਹਾਡੇ ਰੈਸਟੋਰੈਂਟ ਤੋਂ ਖਾਣਾ ਔਰਡਰ ਕੀਤਾ ਸੀ ਅਤੇ ਮੈਨੂੰ ਤੁਹਾਡੀ ਸਬਜ਼ੀਆਂ ਅਤੇ ਬਟਰ ਨਾਨ ਬਹੁਤ ਸੁਆਦ ਲੱਗੇ ਬਸ ਤੁਹਾਡੇ ਥੋੜ੍ਹੇ ਜਿਹੇ ਰੇਟ ਜ਼ਿਆਦਾ ਸੀਗੇ ਤਾਂ ਮੈਂ ਕਿਰਪਾ ਕਰਕੇ ਕਹਿੰਦਾ ਤੁਹਾਨੂੰ ਰੇਟ ਥੋੜ੍ਹਾ ਘੱਟ ਕੀਤਾ ਜਾਵੇ ਤਾਂ ਤਾਂ ਜੋ ਸਾਰੇ ਲੋਕ ਕੀ ਤੁਹਾਡੇ ਤੋਂ ਆਰਾਮ ਨਾਲ ਔਰਡਰ ਮੰਗਾ ਸਕੀਏ ਅਤੇ ਤੁਹਾਡੇ ਰੈਸਟੋਰੈਂਟ ਦਾ ਵੀ ਖੂਬ ਨਾਂ ਹੋ ਅਤੇ ਤੁਹਾਡਾ ਰੈਸਟੋਰੈਂਟ ਇੱਦਾਂ ਹੀ ਚੱਲਦਾ ਰਹੇ ਧੰਨਵਾਦ ਤੁਹਾਡੀ ਸਰਵਿਸ ਲਈ